ਇਹ ਗੁਰਦੁਆਰਾ ਕਮੇਟੀ ਤੋਂ ਬੋਲਦੇ ਹੈ ਜੀ ਅਤੇ ਮੈਂ ਆਪਣੇ ਨਾ ਲੜਕੇ ਦੀ ਐਡਮਿਸ਼ਨ ਕਰਵਾਉਣੀ ਸੀ ਟਕਸਾਲ ਦੇ ਵਿੱਚ ਬੱਚਾ ਜੀ ਅੱਠ ਸਾਲ ਦਾ ਅਤੇ ਕੀ ਕੀ ਅਤੇ ਹਾਂਜੀ ਅਤੇ ਕੀ ਕੀ ਸਿਖਾਉਂਦੇ ਹੋ ਵਿੱਚ

ਅਤੇ ਕਿਨ ਕੀ ਕੀ ਸਿਖਾਉਂਗੇ ਤੁਸੀਂ ਉਹਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਰਮੋਨੀਅਮ ਵਗੈਰਾ ਵੀ ਸਿਖਾਉਂਗੇ ਠੀਕ ਹੈ ਜੀ ਅਤੇ ਫੀਸ ਵਗੈਰਾ ਦਾ ਕੀ ਹਿਸਾਬ ਹੋਵੇਗਾ ਠੀਕ ਹੈ ਜੀ ਅਤੇ ਹਾਂਜੀ ਅਤੇ ਇਸ ਤੋਂ ਇਲਾਵਾ ਹੋਰ ਕੁਝ ਠੀਕ ਹੈ ਜੀ ਠੀਕ ਹੈ ਜੀ

ਉਹਨਾਂ ਦੇ ਮਤਲਬ ਰਹਿਣ ਸਹਿਣ ਦਾ ਕੋਈ ਖਰਚਾ ਹੋਰ

ਹਾਂਜੀ ਠੀਕ ਹੈ ਜੀ ਅਤੇ ਹੋਰ ਫਿਰ ਕਦੋਂ ਕੁ ਆਈਏ ਤੁਹਾਡੇ ਕੋਲ ਹਾਂਜੀ ਠੀਕ ਹੈ ਜੀ ਅਤੇ ਕਿੰਨੇ ਵਜੇ ਤੱਕ ਖੁੱਲ੍ਹੀ ਹੁੰਦੀ ਆ

ਹਾਂਜੀ ਕੋਈ ਨਹੀਂ ਫਿਰ ਮੈਂ ਆ ਜਾਂਦਾ ਤਿੰਨ ਚਾਰ ਦਿਨ ਤੱਕ ਤੁਹਾਨੂੰ ਆਉਣ ਤੋਂ ਆਉਣ ਤੋਂ ਪਹਿਲਾਂ ਫੋਨ ਲਗਾ ਦੂੰਗਾ ਅਤੇ ਫਿਰ ਮਿਲ ਲਵਾਂਗੇ ਅਤੇ ਨਾਲ ਬੱਚਿਆਂ ਨੂੰ ਮਿਲਾ ਦੂੰਗਾ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ